ਹੈਲੋ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਰੈਲ ਮਾਜਰੇ ਤੋਂ ਬੋਲ ਰਹੀ ਹਾਂ ਕੀ ਤੁਸੀਂ ਪੀਜ਼ਾ ਸਟੋਰ ਤੋਂ ਗੱਲ ਕਰ ਰਹੇ ਹੋ ਮੈਂ ਪੀਜ਼ਾ ਸਟੋਰ ਤੋਂ ਥੋੜ੍ਹੀ ਦੇਰ ਕੁਛ ਟਾਈਮ ਪਹਿਲਾਂ ਪੀਜ਼ਾ ਔਡਰ ਕੀਤਾ ਸੀ ਪੀਜ਼ਾ ਇੱਕ ਤਾਂ ਬਹੁਤ ਲੇਟ ਆਇਆ ਅਤੇ ਉਹ ਠੰਡਾ ਵੀ ਸੀ ਜਦੋਂ ਮੈਂ ਉਹਨੂੰ ਚੈੱਕ ਕੀਤਾ ਅਤੇ ਉਸਦੇ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਜਦੋਂ ਮੈਂ ਉਸਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਉਸਦੇ ਵਿੱਚ ਜਿਹੜੀ ਚੀਜ਼ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਸੀਗੀ ਜਾਂ ਤਾਂ ਹੁਣ ਮੇਰਾ ਉਹਨੂੰ ਮਨ ਦੇਖ ਕੇ ਮਨ ਬਹੁਤ ਖਰਾਬ ਹੋਇਆ ਜਾਂ ਤਾਂ ਹੁਣ ਤੁਸੀਂ ਪੈਸੇ ਰਿਫੰਡ ਕਰ ਦਿਉ ਕਿਉਂਕਿ ਮੈਂ ਔਨਲਾਈਨ ਪੇਮੈਂਟ ਕਰ ਚੁੱਕੀ ਸੀ ਪਹਿਲਾਂ ਜਾਂ ਫਿਰ ਤੁਸੀਂ ਮੈਨੂੰ ਪੀਜ਼ਾ ਜਲਦੀ ਤੋਂ ਜਲਦੀ ਭੇਜ ਦਿਉ ਵੈਸੇ ਤਾਂ ਹੁਣ ਮੇਰਾ ਪੀਜ਼ੇ ਨੂੰ ਦੇਖ ਕੇ ਖਰਾਬ ਪੀਜ਼ਾ ਦੇਖ ਕੇ ਮੇਰਾ ਤਾਂ ਹੁਣ ਜੀਅ ਨਹੀਂ ਕਰ ਰਿਹਾ ਕਿ ਮੈਂ ਪੀਜ਼ਾ ਮੰਗਾਵਾਂ ਵੀ ਤੁਹਾਡੇ ਤੋਂ ਜਾਂ ਹੁਣ ਤੁਸੀਂ ਐਵੇਂ ਕਰੋ ਮੇਰੇ ਪੈਸੇ ਜਾਂ ਫਿਰ ਰਿਫੰਡ ਕਰ ਦਿਉ ਬਾਕੀ ਮੈਂ ਤੁਹਾਡੀ ਵੇਟ ਕਰਾਂਗੀ ਕਿ ਤੁਸੀਂ ਪੈਸੇ ਰਿਫੰਡ ਕਰ ਰਹੇ ਹੋ ਜਾਂ ਫਿਰ ਪੀਜ਼ਾ ਦੇ ਰਹੇ ਹੋ ਓਕੇ ਥੈਂਕ ਯੂ